ਹੈਲੋ ਹਾਂਜੀ ਤੁਸੀਂ ਕੌਣ ਹਾਂਜੀ ਮੈਂ ਪ੍ਰਿਯੰ ਪ੍ਰਿਯੰਕਾ ਬੋਲ ਰਹੀ ਸੀ ਅਸੀਂ ਔਨਲਾਈਨ ਮ ਮੋਬਾਈਲ ਮੰਗਵਾਉਣਾ ਸੀ ਹਾਂਜੀ ਤੁਹਾਡੇ ਕੋਲ ਕਿਹੜੇ ਕਿਹੜੇ ਮੋਡਲਸ ਹੋਣਗੇ ਇਹ ਤੁਸੀਂ ਓਪੋ ਦੇ ਮੋਬਾਈਲ ਕਿੰਨੀ ਕੁ ਰੇਂਜ ਤੱਕ ਹੈਗੇ ਆ ਤੁਹਾਡੇ ਕੋਲ ਸਭ ਤੋਂ ਵਧੀਆ ਕਿੰਨ ਕਿੰਨੇ ਕੁ 'ਚ ਪੈ ਜੇਗਾ ਨਹੀਂ ਮੰਨ ਲਉ ਜੋ ਤੀਹ ਤੀਹ ਹਜ਼ਾਰ ਵਾਲਾ ਵੀ ਆ ਉਹਦੇ 'ਤੇ ਤੁਸੀਂ ਕਿੰਨਾ ਕੁ ਡਿਸਕਾਊਂਟ ਦਿਓਗੇ ਸਾਨੂੰ ਪੱਚੀ ਹਜ਼ਾਰ ਤੱਕ ਨਹੀਂ ਹੋ ਸਕਦਾ ਕਿਉਂਕਿ ਤੁਹਾਡੀ ਤਾਂ ਔਨਲਾਈਨ ਸੁਵਿਧਾ ਤੁਹਾਨੂੰ ਤਾਂ ਉੱਧਰੋਂ ਵੀ ਬਚਤ ਹੁੰਦੀ ਹੀ ਹੈ

ਸਾਨੂੰ ਇੱਕ ਹੀ ਚਾਹੀਦਾ ਨਹੀਂ ਨਹੀਂ ਸਾਨੂੰ ਓਪੋ ਦਾ ਹੀ ਚਾਹੀਦਾ ਅਤੇ ਜੇਕਰ ਕੋਈ ਵੀ ਮਤਲਬ ਮੋਬਾਈਲ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਉਂਦੀ ਤਾਂ ਤੁਸੀਂ ਮਤਲਬ ਬਦਲ ਸਕਦੇ ਆਂ ਕਿ ਨਹੀਂ ਅਤੇ ਡਿਲੀਵਰੀ ਦੀ ਡ ਜੇ ਮੰਨ ਲਉ ਆਪਾਂ ਫੋਨ ਬਦਲਦੇ ਹਾਂ ਤਾਂ ਡਿਲੀਵਰੀ ਦੇ ਜੋ ਜੋ ਚਾਰਜਸ ਹੋਣਗੇ ਉਹ ਦੁਬਾਰਾ ਤਾਂ ਨਹੀਂ ਪੇ ਕਰਨੇ ਪੈਣਗੇ ਹਾਂਜੀ ਫਿਰ ਮੈਂ ਹਾਂਜੀ ਫਿਰ ਮੈਂ ਤੁਹਾਨੂੰ ਆਪਦਾ ਨਾਮ ਅਤੇ ਐਡਰੈਸ ਸਾਰਾ ਕੁਝ ਸੈਂਡ ਕਰਦੀ ਹਾਂ ਠੀਕ ਆ ਥੈਂਕ ਯੂ